ਦੋ ਲੱਖ ਛਿਆਹਠ ਹਜ਼ਾਰ ਪੰਜ ਸੌ ਵੀਹ ਨੌ ਲੱਖ ਬਾਈ ਹਜ਼ਾਰ ਅੱਠ ਸੌ ਤੀਹ ਛੇ ਲੱਖ ਚੁਰੰਜਾ ਹਜ਼ਾਰ ਪੰਜ ਸੌ ਵੀਹ ਇੱਕ ਲੱਖ ਗਿਆਰਾਂ ਹਜ਼ਾਰ ਨੌ ਸੌ ਚਾਲੀ ਨੌ ਲੱਖ ਪਚਵੰਜਾ ਹਜ਼ਾਰ ਪੰਜ ਸੌ ਪੰਜ